ਪੰਜਾਬ ਵਿੱਚ ਵਪਾਰ ਹੋਰ ਰਾਜਾਂ ਨਾਲੋਂ ਵੱਖਰਾ ਹੈ ਦੋ ਸੋ ਟੈਲਰੀਆਂ ਚਮੜਾ ਉਦਯੋਗ ਨੂੰ ਮਜ਼ਬੂਤ ਕਰਦੀਆਂ ਹਨ ਛੋਟੇ ਉਦਯੋਗ ਜਿਵੇਂ ਮਸ਼ੀਨਰੀ ਅਤੇ ਸਪੇਅਰ ਪਾਰਟਸ ਅਤੇ ਵੱਡੇ ਉਦਯੋਗ ਜਿਵੇਂ ਖੇਤੀ ਮਸ਼ੀਨਰੀ ਅਤੇ ਟੈਕਸਟਾਈਲ ਇੱਥੇ ਖਾਸ ਹਨ ਪੰਜਾਬੀ ਵਿਆਪਾਰੀ ਤੇਜ਼ ਫੈਸਲੇ ਵਿਸ਼ਵਾਸ ਅਤੇ ਨਵੀਆਂ ਮੌਕਿਆਂ ਦੀ ਖੋਜ ਵਿੱਚ ਰਹਿੰਦੇ ਹਨ ਇਹ ਦਿਲਦਾਰੀ ਅਤੇ ਉਦਯੋਗਿਕ ਸ਼ਕਤੀ ਇਸ ਨੂੰ ਹੋਰ ਰਾਜਾਂ ਤੋਂ ਵੱਖਰਾ ਬਣਾਉਂਦੀ ਹੈ